ਅਸੀਂ ਘਰ ਵਿੱਚ ਬਹੁਤ ਸਾਰੀਆਂ ਪੀਣ ਵਾਲੀਆਂ ਚੀਜ਼ਾਂ ਬਣਾਉਂਦੇ ਹਨ ਪਰ ਗਰਮੀਆਂ ਵਿੱਚ ਅਸੀਂ ਜ਼ਿਆਦਾਤਰ ਨਿੰਬੂ ਪਾਣੀ ਜਲਜੀਰਾ ਜਾਂ ਸਕੈਸ਼ ਬਣਾਉਂਦੇ ਹਨ ਕਿਉਂਕਿ ਇਹ ਪੀ ਕੇ ਸਾਨੂੰ ਬਹੁਤ ਵਧੀਆ ਮਹਿਸੂਸ ਹੁੰਦਾ ਹੈ ਗਰਮੀਆਂ ਵਿੱਚ ਇਹ ਪੀ ਕੇ ਬਹੁਤ ਵਧੀਆ ਲੱਗਦਾ ਹੈ ਅਤੇ ਇਹ ਬਹੁਤ ਸਵਾਦ ਵੀ ਹੁੰਦਾ ਹੈ ਅਸੀਂ ਘਰ ਪੀਣ ਲਈ ਬਨਾਨਾ ਸ਼ੇਕ ਮੈਂਗੋ ਸ਼ੇਕ ਵਗੈਰਾ ਵੀ ਬਣਾਉਂਦੇ ਹਾਂ ਅਸੀਂ ਕੋਫੀ ਵੀ ਬਣਾਉਂਦੇ ਹਾਂ ਬਨਾਨਾ ਸ਼ੇਕ ਅਤੇ ਮੈਂਗੋ ਸ਼ੇਕ ਸਾਡੀ ਸਿਹਤ ਵਾਸਤੇ ਬਹੁਤ ਵਧੀਆ ਹੁੰਦਾ ਹੈ ਇਹ ਸਾਡੇ ਸ਼ਰੀਰ ਨੂੰ ਤੰਦਰੁਸਤ ਰੱਖਦਾ ਹੈ ਅਸੀਂ ਕੋਫੀ ਵਗੈਰਾ ਵੀ ਬਣਾਉਂਦੇ ਹਾਂ ਅਸੀਂ ਪੀਣ ਵਾਲ਼ੀਆਂ ਬਹੁਤ ਸਾਰੀਆਂ ਚੀਜ਼ਾਂ ਘਰੇ ਬਣਾ ਸਕਦੇ ਹਾਂ